ਅਠਾਈ ਫਰਵਰੀ ਉੱਨੀ ਸੌ ਬਾਨਵੇਂ ਅ ਪੰਦਰਾਂ ਦਸੰਬਰ ਦੋ ਹਜ਼ਾਰ ਅਠਾਰਾਂ ਇਕੱਤੀ ਮਾਰਚ ਦੋ ਹਜ਼ਾਰ ਵੀਹ ਇੱਕੀ ਨਵੰਬਰ ਦੋ ਹਜ਼ਾਰ ਬਾਈ ਸੋਲਾਂ ਦਸੰਬਰ ਦੋ ਹਜ਼ਾਰ ਇੱਕੀ